ਹਾਂਜੀ ਵਿਹੜੇ ਵਿੱਚ ਖੂਬ ਸਾਰੇ ਪੌਦੇ ਲਗਾਏ ਹਨ ਮੈਂ ਮੇਰੇ ਘਰ ਦੇ ਵਿਹੜੇ ਵਿੱਚ ਬਹੁਤ ਸੋਹਣੇ ਸੋਹਣੇ ਫੁੱਲ ਪੇੜ ਪੌਦੇ ਲੱਗੇ ਅੰਬ ਦਾ ਬੂਟਾ ਵੀ ਲੱਗਿਆ ਹੋਇਆ ਖਰ ਖਰਬੂਜੇ ਦੇ ਬੀਜ ਵੀ ਮੈਂ ਪਾਏ ਖਰਬੂਜੇ ਲੱਗਣ ਔਰ ਅਮਰੂਦ ਦਾ ਵੀ ਪੇੜ ਲੱਗਿਆ ਕਿਨੂੰ ਦਾ ਪੇੜ ਲੱਗਿਆ ਹੈ ਉਸ ਪੇੜ ਦੇ ਉੱਤੇ ਬਹੁਤ ਸੋਹਣੇ ਸੋਹਣੇ ਆ ਕੇ ਪੰਛੀ ਬੈਠਦੇ ਹਨ ਅਤੇ ਜਿਹਨਾਂ ਜਿਹੜੇ ਵੀ ਪੰਛੀ ਆਉਂਦੇ ਨੇ ਉਹਨਾਂ ਨੂੰ ਮੈਂ ਦਾਨਾ ਦਾਨਾ ਵੀ ਖਵਾਨੀ ਹਾਂ ਅਤੇ ਪਾਣੀ ਵੀ ਰੱਖਿਆ ਹੋਇਆ ਹੈ ਪਾਣੀ ਪੀਣ ਨੂੰ ਵੀ ਦੇਣੀ ਆ ਮੈਂ ਉਨ ਦੇ ਉਹਨਾਂ ਦੇ ਘਰ ਵੀ ਬਣਾਏ ਹੋਏ ਨੇ ਛੋਟੇ ਛੋਟੇ ਬਣੇ ਬਣਾਏ ਵੀ ਮੈਂ ਘੌਸਲੇ ਲੈ ਕੇ ਆਈ ਹੈ ਤਾਂ ਕਿ ਉਹਨਾਂ ਨੂੰ ਦੇਖ ਕੇ ਜਿਹੜੇ ਵੀ ਪੰਛੀ ਨੇ ਆਕਰਸ਼ਿਤ ਹੋ ਸਕਣ ਔਰ ਆ ਕੇ ਆ ਕੇ ਉਹ ਦਾਣਾ ਚੁਗਣ ਪਾਣੀ ਪੀਣ ਔਰ ਆਪ ਉਸ ਘੌਂਸਲੇ ਵਿੱਚ ਰਹਿਣ ਆਪਣੇ ਅੱਗੋਂ ਪਰਿਵਾਰ ਨੂੰ ਵਧਾਉਣ ਪੰਛੀ ਨੂੰ ਚਹਿਕਦੇ ਬਹਿਕਦੇ ਦੇਖ ਕੇ ਮੈਂ ਬਹੁਤ ਖੁਸ਼ ਹੁੰਦੀ ਹਾਂ ਉਹਨਾਂ ਨੂੰ ਦੇਖ ਕੇ ਜੋ ਹੋਰ ਵੀ ਪੰਛੀ ਆ ਜਾਂਦੇ ਹਨ